ਕੁਸ਼ਤੀ ਪੰਜਾਬ ਦੀ ਪਰੰਪਰਾਗਤ ਖੇਡ ਹੈ ਕੁਸ਼ਤੀ ਵਿੱਚ ਲੋਕ ਬਹੁਤ ਹੀ ਸੋਹਣਾ ਪ੍ਰਦਰਸ਼ਨ ਕਰਦੇ ਹਨ ਪੰਜਾਬ ਦੀ ਟੀਮ ਜੇ ਕਿਤੇ ਡਿਸਟਰਿਕਟ ਲੈਵਲ ਦੀ ਹੋਵੇ ਭਾਵੇਂ ਹੋਵੇ ਇਹ ਨੈਸ਼ਨਲ ਲੈਵਲ 'ਤੇ ਕੁਸ਼ਤੀ ਦੇ ਵਿੱਚ ਹਮੇਸ਼ਾ ਹੀ ਪੰਜਾਬ ਅੱਗੇ ਰਹਿੰਦਾ ਪੰਜਾਬ ਦੀ ਖੁਰਾਕ ਉਹਨਾਂ ਨੂੰ ਇੰਨਾ ਤਾਕਤਵਰ ਬਣਾ ਦਿੰਦੀ ਹੈ ਕਿ ਇੱਥੇ ਦੁੱਧ ਲੱਸੀ ਅਤੇ ਜਿਵੇਂ ਹਰਿਆਣੇ ਦੇ ਵਿੱਚ ਹੈ ਪੰਜਾਬ ਦੇ ਵਿੱਚ ਵੀ ਖਾਣ ਪਾਣ ਬਹੁਤ ਹੀ ਵਧੀਆ ਹੈ ਜਿਹੜਾ ਕਿ ਖਿਡਾਰੀਆਂ ਨੂੰ ਬਹੁਤ ਹੀ ਤੰਦਰੁਸਤ ਬਣਾਉਂਦਾ ਹੈ ਅਤੇ ਖਿਡਾਰੀਆਂ ਨੂੰ ਇੰਨਾ ਵਧੀਆ ਪ੍ਰਦਰਸ਼ਨ ਕਰਵਾਉਂਦਾ ਹੈ ਖਾਸ ਕਰ ਕੁਸ਼ਤੀ ਦੇ ਵਿੱਚ ਕੁਸ਼ਤੀ ਦੇ ਵਿੱਚ ਪੰਜਾਬ ਤੋਂ ਅੱਗੇ ਕੋਈ ਨਹੀਂ ਜਾ ਸਕਦਾ ਅਤੇ ਨਾ ਹੀ ਗਿਆ ਹੈ ਕੁਸ਼ਤੀ ਪੰਜਾਬ ਦੀ ਇੱਕ ਪਰੰਪਰਾਗਤ ਖੇਡ ਹੈ ਜਿਵੇਂ ਕਿ ਇਹ ਕੁਸ਼ਤੀ ਦੇ ਵਿੱਚ ਬਹੁਤ ਸਾਰੇ ਪਲੇਅਰ ਖੇਡੇ ਨੇ ਹਰਿਆਣੇ ਦੇ ਵਿੱਚ ਵੀ ਬਹੁਤ ਵਧੀਆ ਖੁਰਾਕ ਹੈ ਅਤੇ ਪੰਜਾਬ ਦਾ ਪੂਰਾ ਮੁਕਾਬਲਾ ਵੀ ਕਰਦੀ ਹੈ ਅਤੇ ਪਰ ਪੰਜਾਬ ਦਾ ਖਾਣ ਪਾਣ ਖਾਣ ਪਾਣ ਜਿਹੜਾ ਹੈਗਾ ਉਹ ਇੰਨਾ ਕੁ ਵਧੀਆ ਹੈਗਾ ਅਤੇ ਇੱਥੇ ਦੇ ਲੋਕ ਜਿਹੜੇ ਹੈਗੇ ਖਿਡਾਰੀ ਖਾਸ ਕਰ ਬਹੁਤ ਵਧੀਆ ਪ੍ਰਦਰਸ਼ਨ ਦਿੰਦੇ ਹਨ